ਹੈਲੋ ਹਾਂਜੀ ਹਾਂਜੀ ਨਮਸਕਾਰ ਜੀ ਕਿੱਦਾਂ ਠੀਕ ਠਾਕ ਹਾਂਜੀ ਅੱਛਾ ਜੀ ਲੈਣਾ ਚਾਹੁੰਦੇ ਹੋ ਠੀਕ ਆ ਜੀ ਬੱਚਾ ਕਿੰਨੇ ਸਾਲ ਦਾ ਹੈ ਜੀ ਅੱਛਾ ਅਤੇ ਉਹਦੇ ਲਈ ਸਾਈਕਲ ਹੈਗੇ ਆ ਸਾਡੇ ਕੋਲ ਕਾਫੀ ਜ਼ਿਆਦਾ ਵਰਾਇਟੀ ਹੈ ਸਾਈਕਲ 'ਚ ਤੁਸੀਂ ਆਪਣੀ ਰੇਂਜ ਦੱਸ ਸਕਦੇ ਹੋ ਕਿੰਨੀ ਕੁ ਰੇਂਜ ਤੱਕ ਤੁਸੀਂ ਲੈਣਾ ਓਕੇ ਜੀ ਇੱਕ ਸਾਡੇ ਕੋਲ ਸਾਈਕਲ ਹੈਗਾ ਜੀ ਦਸ ਹਜ਼ਾਰ ਰੇਂਜ ਤੋਂ ਸ਼ੁਰੂ ਹੈ ਕਲਰ ਉਹਦੇ ਵਿੱਚ ਤਿੰਨ ਮਿਲਣਗੇ ਇੱਕ ਬਲੈਕ ਹੈ ਬਲਿਊ ਹੈ ਔਰ ਰੈੱਡ ਹੈ ਠੀਕ ਹੈ ਜੀ ਹਾਂਜੀ ਡਿਸਕਾਊਂਟ ਮਿਲ ਜਾਏਗਾ ਤੁਸੀਂ ਸਤ ਦੱਸ ਤੁਸੀਂ ਆਪਣੇ ਵੱਲੋਂ ਸਾਨੂੰ ਕਲੀਅਰ ਕਰੋ ਨਾ ਤੁਸੀਂ ਲੈਣਾ ਪੱਕਾ ਠੀਕ ਹੈ ਜੀ ਤੁਹਾਨੂੰ ਡਿਸਕਾਊਂਟ ਮੇਰੇ ਵੱਲੋਂ ਮਿਲ ਜਾਏਗਾ ਮੈਡਮ ਦ ਕੋਈ ਛੇ ਕੁ ਪਰਸੈਂਟ ਤੱਕ ਡਿਸਕਾਊਂਟ ਮਿਲ ਜਾਂਦਾ ਹਾਂਜੀ ਹੋਰ ਦੱਸੋ ਠੀਕ ਹੈ ਜੀ ਓਕੇ ਓਕੇ ਜੀ ਓਕੇ